ਮੇਰੇ ਕੋਲ ਮਨ ਪਸੰਦ ਕੋਈ ਕਿਤਾਬ ਨਹੀਂ ਹੈਗੀ ਨਾ ਕਿ ਬ ਕੋਈ ਨਹੀਂ ਹੈਗੀ ਮੈਂ ਸਿਰਫ ਯੂਟਿਊਬ ਤੋਂ ਵੀ ਵੇਖ ਲੈਂਦੀ ਹਾਂ ਕੋਈ ਵੀ ਜਿਹੜਾ ਮੈਨੂੰ ਚੈਨਲ ਵਧੀਆ ਲੱਗਦਾ ਮੈਂ ਉਥੋਂ ਹੀ ਉਹ ਮਤਲਬ ਕੋਈ ਡਿਜ਼ਾਇਨ ਉਹ ਜਿਹੜਾ ਚੰਗਾ ਲੱਗੇ ਉਹ ਮੈਂ ਉੱਥੇ ਚੱਕ ਲੈਂਦੀ ਹਾਂ ਅਤੇ ਬਾਕੀ ਆਪਦੇ ਜੋ ਦਿਮਾਗ 'ਚ ਆਉਂਦਾ ਉਹ ਕਰ ਲਈਦਾ ਹੌਲੀ ਹੌਲੀ ਕਰਕੇ ਵਧੀਆ ਜੋ ਵੀ ਸੋਹਣਾ ਲੱਗੇ ਡਿਜ਼ਾਇਨ ਉਹ ਮੈਂ ਲੈ ਲੈਂਦੀ ਹਾਂ ਕੁਛ ਕੁਛ ਪੁਰਾਣੇ ਵੀ ਪਾ ਲਈ ਦੇ ਕੁਛ ਨਵੇਂ ਅਤੇ ਕੋਈ ਜਿਵੇਂ ਕੋਈ ਹੋਰ ਚੈਨਲ ਜਿੰਨੇ ਵੀ ਚੱਲਦੇ ਉਹਨਾਂ ਤੋਂ ਕੋਈ ਨਾ ਕੋਈ ਡਿਜ਼ਾਇਨ ਅਸੀਂ ਕੱਢ ਲੈਂਦੇ ਹਾਂ ਅਤੇ ਬਾਕੀ ਇਹੀ ਹੈ ਵੀ ਵਧੀਆ ਬਸ ਮੇਰਾ ਹੀ ਮੇਰਾ ਸ਼ੌਂਕ ਵੀ ਹੈ ਅਤੇ ਮੇਰਾ ਕੰਮ ਵੀ ਹੈ ਇਹ ਅਤੇ ਮਸ਼ਹੂਰੀ ਸਾਡੀ ਮੈਂ ਕਦੀ ਆਪਦੀ ਕੀਤੀ ਨਹੀਂ ਗੀ ਜੋ ਵੀ ਮੇਰੇ ਕੋਲ ਕੋਈ ਬਣਵਾ ਕੇ ਲੈ ਕੇ ਜਾਂਦਾ ਅਤੇ ਉਹ ਅੱਗੇ ਦੱਸ ਦਿੰਦੇ ਆ ਵੀ ਆਹ ਤੁਸੀਂ ਕਿੱਥੋਂ ਬਣਵਾਇਆ ਸਾਨੂੰ ਵੀ ਬਣਵਾ ਕੇ ਦਿਓ ਬਸ ਆਪਦੀ ਮਸ਼ਹੂਰੀ ਮੈਂ ਆਪ ਕਦੀ ਨਹੀਂ ਕੀਤੀ ਇਹ ਜਿਹੜੀਆਂ ਭੈਣਾਂ ਮੇਰੀਆਂ ਆਪ ਜੀ ਆਪ ਦੀ ਮੇਰੀ ਮਸ਼ਹੂਰੀ ਆਪ ਹੀ ਕਰ ਦਿੰਦੀਆਂ ਨੇ ਅਤੇ ਉਹੀ ਮੇਰੇ ਕੋਲ ਆਉਂਦੀਆਂ ਨੇ ਫਿਰ ਵੀ ਸਾਨੂੰ ਵੀ ਆਹ ਬਣਾ ਕੇ ਦਿਉ ਸਾਨੂੰ ਵੀ ਬਣਾ ਕੇ ਦਿਉ ਉਹ ਫਿਰ ਅੱਗੇ ਤੋਂ ਅੱਗੇ ਕੋਈ ਰਿਸ਼ਤੇਦਾਰਾਂ ਨੂੰ ਕਹਿ ਦਿੰਦੇ ਆ ਵੀ ਸਾਨੂੰ ਵੀ ਉੱਥੋਂ ਬਣਾ ਕੇ ਜਿੱਥੋਂ ਤੁਸੀਂ ਬਣਵਾਏ ਸੋਹਣੇ ਬਣੇ ਹੋਏ ਨੇ ਅਤੇ ਆਪਦਾ ਮਨ ਖੁਸ਼ ਹੋ ਜਾਂਦਾ ਵੀ ਚਲੋ ਸਾਡਾ ਜਿਹੜਾ ਕੰਮ ਹੈ ਲੋਕਾਂ ਨੂੰ ਪਸੰਦ ਆਉਂਦਾ ਸਾਡੀ ਕੋਸ਼ਿਸ਼ ਵੀ ਰਹਿੰਦੀ ਹੈ ਵੀ ਲੋਕੀ ਸਾਡਾ ਜੇ ਕੰਮ ਪਸੰਦ ਕਰਦੇ ਅਸੀਂ ਵੱਧ ਤੋਂ ਵੱਧ ਉਹਨਾਂ ਨੂੰ ਮਤਲਬ ਵਧੀਆ ਕੰਮ ਕਰਕੇ ਦਈਏ ਅਤੇ ਸਾਨੂੰ ਖੁਸ਼ੀ ਮਿਲਦੀ ਇਸ ਵਿੱਚ ਅਤੇ ਬਾਕੀ ਅਸੀਂ ਆਪਣੇ ਮਸ਼ਹੂਰੀ ਕੋਈ ਨਹੀਂ ਕਰਦੇ ਅਸੀਂ ਬਿਲਕੁਲ ਨਹੀਂ ਕਰਦੇ ਕਿ ਸਾਡੀ ਇਹੀ ਹੈ ਵੀ ਵੀ ਲੋਕੀ ਆਪ ਮਸ਼ਹੂਰੀ ਕਰਦੇ ਸਾਡੀ